ਲੋਕਾਂ ਨੇ ਲੋਕਡਾਊਨ ਵਿੱਚ ਮੋਬਾਇਲਾਂ ਅਤੇ ਲੈਪਟੋਪਾਂ ਦੀ ਬਹੁਤ ਹੀ ਵਰਤੋਂ ਕੀਤੀ ਹੈ ਕਿਉਂਕਿ ਲੋਕ ਵਿਹਲੇ ਹੁੰਦੇ ਸਨ ਅਤੇ ਵਿਹਲੇ ਹੋਣ ਕਰਕੇ ਆਪਣਾ ਟਾਈਮ ਪਾਸ ਕਰਨ ਲਈ ਕੀ ਕਰਦੇ ਸਨ ਜਾਂ ਤਾਂ ਮੋਬਾਇਲ ਵਰਤਦੇ ਰਹਿੰਦੇ ਹਨ ਜਾਂ ਲੈਪਟਾਪ ਦੇਖਦੇ ਰਹਿੰਦੇ ਹਨ ਅਤੇ ਸਕੂਲਾਂ ਵਿੱਚ ਵੀ ਜੇ ਆਪਾਂ ਕਹਿ ਸਕੀਏ ਸਾਰੇ ਕੰਮ ਜੋ ਹੈ ਉਹ ਔਨਲਾਈਨ ਹੋ ਚੁੱਕੇ ਸਨ ਅਤੇ ਇਹ ਵੀ ਕਹਾਂਗੇ ਵੀ ਔਨਲਾਈਨ ਹੋਣ ਦੇ ਨਾਲ ਕੀ ਹੁੰਦਾ ਸੀਗਾ ਵੀ ਇੱਕ ਤਾਂ ਲੋਕਾਂ ਦੀ ਜੋ ਆਈ ਸਾਈਡ ਆ ਉਹ ਬਹੁਤ ਹੀ ਵੀਕ ਹੋ ਗਈ ਹੈ ਦੂਸਰਾ ਜੋ ਹੈ ਲੋਕ ਜੋ ਹੈ ਵੋ ਫੋਨ 'ਤੇ ਹੀ ਜ਼ਿਆਦਾ ਡਿਪੈਂਡ ਹੋ ਗਏ ਸਨ ਅਤੇ ਜੋ ਮੈਂ ਆਪਣੇ ਤਜੁਰਬੇ ਦੀ ਗੱਲ ਕਰਾਂ ਉਹ ਮੈਂ ਇਹ ਕਹਾਂਗਾ ਵੀ ਚਲੋ ਔਨਲਾਈਨ ਤਾਂ ਚਲੋ ਵਧੀਆ ਸੀਗਾ ਵੀ ਜੇ ਆਪਾਂ ਇੱਕ ਦੂਸਰੇ ਦੇ ਵੱਲ ਨਹੀਂ ਜਾ ਸਕਦੇ ਜਾਂ ਜੋ ਮਨਾਹੀ ਸੀਗੀ ਜੋ ਸਾਨੂੰ ਆਪਣੀ ਸੁਰੱਖਿਆ ਲਈ ਚੀਜ਼ਾਂ ਪ੍ਰਯੋਗ ਕਰਨੀਆਂ ਚਾਹੀਦੀਆਂ ਸਾਨੂੰ ਉਸ ਅਸੀਂ ਕੀਤੀਆਂ ਚਲੋ ਇਹ ਵੀ ਕਹਿ ਸਕਦੇ ਆ ਵੀ ਜਿਹੜੇ ਬੱਚੇ ਸਕੂਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਠੀਕ ਸੀ ਬੱਚਿਆਂ ਨੂੰ ਥੋੜ੍ਹਾ ਜਿਹਾ ਲਿੰਕ ਵਿੱਚ ਰਹਿੰਦੇ ਹਨ ਬਟ ਬੱਚੇ ਜੋ ਸੀ ਇਸ ਦਾ ਮਿਸਯੂਜ ਕਰਨ ਲੱਗ ਪਏ ਸਨ ਉਹ ਕੀ ਕਰਦੇ ਸਨ ਸਟਡੀ ਤੋਂ ਇਲਾਵਾ ਯੂਟੀਊਬ ਖੋਲ ਕੇ ਉਹਨਾਂ ਦਾ ਜੋ ਪੜ੍ਹਨ ਦਾ ਸਿਸਟਮ ਸੀ ਉਹ ਜ਼ਿਆਦਾ ਹੀ ਖ਼ਰਾਬ ਹੋ ਚੁੱਕਾ ਸੀ ਤੇ ਉਹ ਜ਼ਿਆਦਾ ਤੋਂ ਜ਼ਿਆਦਾ ਹੁਣ ਵੀ ਆਪਾਂ ਕਹਿ ਸਕੀਏ ਵੀ ਔਨਲਾਈਨ ਹੋਣ ਕਰਕੇ ਹੁਣ ਵੀ ਆਪਣੇ ਮਾਪਿਆਂ ਨਾਲ ਝੂਠ ਬੋਲਦੇ ਹਨ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਜੋ ਹੈ ਫੋਨ 'ਤੇ ਡਿਪੈਂਡ ਹੋ ਕੇ ਰਹਿ ਗਏ ਹਨ